ਮੈਂ ਆਪਣੇ ਪਰਿਵਾਰ ਨਾਲ ਕਦੇ ਵੀ ਘੁੰਮਣ ਨਹੀਂ ਗਈ ਇਸ ਲਈ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੇ ਪਰਿਵਾਰ ਨਾਲ ਘੁੰਮਣ ਜਾਵਾਂ ਉਹ ਕਿਤੇ ਵੀ ਹੋਵੇ ਭਾਵੇਂ ਧਾਰਮਿਕ ਅਸਥਾਨ ਹੋਵੇ ਮਤਲਬ ਕੋਈ ਵੀ ਮਤ ਅਦਰ ਕੰਟਰੀ ਹੋਵੇ ਅਦਰ ਸਟੇਟ ਹੋਵੇ ਕੋਈ ਅਦਰ ਸ਼ਹਿਰ ਹੋਵੇ ਉਹ ਡ ਉਹ ਨਹੀਂ ਮੈਟਰ ਕਰਦਾ ਪਰ ਹਾਂ ਮੈਨੂੰ ਬਹੁਤ ਪਸੰਦ ਹੈ ਕਿ ਮੇਰਾ ਪੂਰਾ ਪਰਿਵਾਰ ਅਤੇ ਮੈਂ ਉਹਨਾਂ ਨਾਲ ਜਾਵਾਂ ਅਤੇ ਮਤਲਬ ਕਿਤੇ ਵੀ ਘੁੰਮ ਕੇ ਆਵਾਂ ਉਹ ਭਾਵੇਂ ਘਰ ਤੋਂ ਬਾਹਰ ਹੀ ਕਿਸੇ ਦੂਸਰੇ ਸ਼ਹਿਰ 'ਤੇ ਹੀ ਹੋਵੇ ਉਹ ਕੋਈ ਗੱਲ ਨਹੀਂ ਹੈਗੀ ਪਰ ਹਾਂ ਮੈਂ ਚਾਹੁੰਦੀ ਹਾਂ ਕਿ ਮੈਂ ਉਹਨਾਂ ਨਾਲ ਘੁੰਮਾਂ ਦੇਖਾਂ ਖਾਵਾਂ ਪੀਵਾਂ ਇੰਜੋਏ ਕਰਾਂ ਅਤੇ ਵਧੀਆ ਢੰਗ ਨਾਲ਼ ਅਸੀਂ ਕਿਤੇ ਮਤਲਬ ਜਾਈਏ ਮਤਲਬ ਟਾਈਸ ਟਾਈਮ ਜਿਹੜਾ ਸਪੈਂਟ ਕਰਕੇ ਆਈਏ ਅਤੇ ਹਾਂ ਪਾਪਾ ਮੰਮੀ ਬੜੇ ਮੰਮੀ ਬੜੇ ਪਾਪਾ ਸਾਰੇ ਮਤਲਬ ਸਾਰੇ ਫੈਮਲੀ ਮੈਂਬਰ ਹੋਣ ਅਤੇ ਅਸੀਂ ਇਕੱਠੇ ਘੁੰਮ ਕੇ ਆਈਏ